ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਡਮ ਮੈਂ ਬ੍ਰਿਟਿਸ਼ ਕੋਐਡ ਸਕੂਲ ਪਟਿਆਲਾ ਤੋਂ ਗੱਲ ਕਰ ਰਹੀ ਐਂ ਤੁਸੀਂ ਅਗਮ ਦੇ ਪੇਰੈਂਟਸ ਬੋਲ ਰਹੇ ਹੋ ਮੈਡਮ ਐਕਚੁਲੀ ਹੁਣ ਸਕੂਲ ਦੇ ਵਿੱਚ ਫਸਟ ਯੂਨਿਟ ਦੇ ਟੈਸਟ ਕੰਪਲੀਟ ਹੋ ਕੇ ਚੁੱਕੇ ਹੈ ਮੈਂ ਤੁਹਾਡੀ ਬੇਟੀ ਦੀ ਪਰਫੋਰਮੈਂਸ ਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦੀ ਸੀ ਵੈਸੇ ਤਾਂ ਤੁਹਾਨੂੰ ਪਤਾ ਹੀ ਹੋਏਗਾ ਕਿ ਤੁਹਾਡੀ ਬੇਟੀ ਕਿੰਨਾ ਟਾਈਮ ਪੜ੍ਹਦੀ ਰਹੀ ਹੈ ਆਪਣਾ ਘਰ ਆ ਕੇ ਕਿੰਨੀ ਪ੍ਰੈਪਰੇਸ਼ਨ ਕਰਦੀ ਰਹੀ ਹੈ ਮੈਮ ਦੇਖੋ ਕਿਉਂਕਿ ਬੱਚੇ ਨੇ ਨੋਨ ਮੈਡੀਕਲ ਲਿਤਾ ਹੋਇਆ ਅਤੇ ਨੈਚੁਰਲੀ ਉਹ ਕੋਚਿੰਗ ਇੰਸਟੀਟਿਊਟ 'ਚ ਜਾਂਦਾ ਹੋਏਗਾ ਜਾਂਦੀ ਹੋਏਗੀ ਚਲੋ ਸੀਟ ਤਾਂ ਠੀਕ ਹੈ ਮੈਡਮ ਡੰਮੀ ਹੈ ਪਰ ਪ੍ਰੈਕਟੀਕਲ ਪਰਫੋਰਮੈਂਸ ਦੀ ਤਾਂ ਤੁਹਾਡੇ ਨਾਲ ਗੱਲ ਹੋਈ ਸੀ ਕਿ ਉਹਨੂੰ ਪ੍ਰੈਕਟੀਕਲਸ ਤਾਂ ਦੇਣੇ ਹੀ ਪੈਣਗੇ ਅਤੇ ਅਸੀਂ ਪ੍ਰੈਕਟੀਕਲਸ ਦੇ ਲਈ ਕੁਛ ਐਕਸਟਰਾ ਕਲਾਸਿਸ ਲਗਾਈਆਂ ਸੀਗੀਆਂ ਫਿਜਿਕਸ ਦੀਆਂ ਵੀ ਲਗਾਈਆਂ ਸੀ ਕੈਮਿਸਟਰੀ ਦੀਆਂ ਵੀ ਲਗਾਈਆਂ ਸੀ ਪਰ ਤੁਹਾਡੀ ਬੇਟੀ ਨੇ ਆ ਕੇ ਇੱਥੇ ਰਿਪੋਰਟ ਨਹੀਂ ਕੀਤਾ ਅਤੇ ਮੈਡਮ ਅਸੀਂ ਨਾ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਸੀ ਕਿ ਅਸੀਂ ਇੱਕ ਵੀਕ ਹੋਰ ਰੱਖ ਲਿਆ ਬੱਚਿਆਂ ਨੂੰ ਐਕਸਟਰਾ ਸਮਝਾਉਣ ਵਾਸਤੇ ਤਾਂ ਕਿ ਉਹਨਾਂ ਨੂੰ ਫਾਈਨਲ ਇਗਜ਼ਾਮ ਦੇ ਵਿੱਚ ਪ੍ਰੋਬਲਮ ਨਾ ਆਵੇ ਤੁਸੀਂ ਆਪਣੀ ਬੇਟੀ ਨੂੰ ਭੇਜ ਸਕਦੇ ਹੋ ਮਤਲਬ ਕਿ ਨੈਕਸਟ ਵੀਕ ਮੰਡੇ ਟੂ ਥਰਸਡੇ ਦੇ ਡਿਊਰਿੰਗ ਅਸੀਂ ਦੋ ਦੋ ਘੰਟੇ ਦੀਆਂ ਕਲਾਸਾਂ ਲਵਾਂਗੇ

ਹਾਂਜੀ ਹਾਂਜੀ ਅਤੇ ਮੈਡਮ ਫਿਰ ਠੀਕ ਹੈ ਨੈਕਸਟ ਵੀਕ ਆਪਣਾ ਬੱਚੇ ਨੂੰ ਭੇਜਣਾ ਸ਼ਿਓਰ ਕਰ ਲਓ ਠੀਕ ਹੈ ਮੈਡਮ ਹਾਂ ਥੈਂਕ ਯੂ ਹਾਂ ਥੈਂਕ ਯੂ ਮੈਡਮ ਥੈਂਕ ਯੂ ਜੀ ਥੈਂਕ ਯੂ ਮੈਡਮ ਓਕੇ ਜੀ